ਚੋਣਾਂ ਦੌਰਾਨ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਚੋਣਾਂ ਸੀ ਉਸ ਦਿਨ ਬਹੁਤ ਗਰਮੀ ਸੀ ਉੱਥੇ ਨਾ ਪਾਣੀ ਦਾ ਨਾ ਪੱਖਿਆਂ ਦਾ ਕੋਈ ਸਿਸਟਮ ਨਹੀਂ ਸੀ ਬਜ਼ੁਰਗਾਂ ਨੂੰ ਵੀ ਬਹੁਤ ਮੁਸ਼ਕਿਲਾਂ ਆ ਰਹੀਆਂ ਸਨ ਅਤੇ ਉੱਥੇ ਉਮੀਦਵਾਰ ਪਬਲਿਕ ਨੂੰ ਦਬਾਵ ਪਾ ਰਹੇ ਸੀ ਕਿ ਸਾਡੇ ਚੋਣ ਨਿਸ਼ਾਨ ਨੂੰ ਵੋਟ ਪਾਓ ਇੱਦਾਂ ਕਰ ਕੇ ਉਹ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਸੀ ਜੋ ਕਿ ਬਿਲਕੁਲ ਗਲਤ ਹੈ